ਅੱਜ ਕੱਲ੍ਹ ਰਸੋਈ ਘਰ ਦੇ ਵਿੱਚ ਬਿਜਲੀ ਦੇ ਉਪਕਰਣ ਬਹੁਤ ਜ਼ਿਆਦਾ ਵਰਤੇ ਜਾਂਦੇ ਹਨ ਪੁਰਾਣੇ ਦਿਨਾਂ ਨਾਲੋਂ ਪੁਰਾਣੇ ਸਮੇਂ ਨਾਲੋਂ ਤਜ਼ਰਬਾ ਹੁਣ ਜ਼ਿਆਦਾ ਹੋ ਗਿਆ ਹੈ ਕਿਉਂਕੀ ਬਿਜਲੀ ਦੇ ਨਵੇਂ ਉਪਕਰਣ ਨਾਲ ਰਸੋਈ ਦੇ ਕੰਮ ਕਾਜ਼ ਸਾਰੇ ਸੌਖੇ ਹੋ ਗਏ ਹਨ ਜਿਨ੍ਹਾਂ ਕਰਕੇ ਕੋਈ ਵੀ ਡਿਸ਼ ਬਣਾਉਣ ਨੂੰ ਟਾਇਮ ਨਹੀਂ ਲੱਗਦਾ ਪਹਿਲਾਂ ਲੱਸੀ ਦੇ ਲਈ ਹੱਥ ਨਾਲ ਰਿੜਕਦੇ ਅਤੇ ਲੱਸੀ ਮਧਾਣੀ ਪਾ ਕੇ ਵਿੱਚ ਫਿਰ ਓਹਤੇ ਹੋਲੀ ਹੋਲੀ ਲੱਸੀ ਦੇ ਉੱਪਰ ਮੋਟਰ ਲਾਲੀ ਮਸ਼ੀਨ ਆ ਗਈ ਫਿਰ ਉਹਦੇ ਨਾਲ ਰਿੜਕਣ ਲੱਗ ਗਏ ਉਹ ਕੰਮ ਸੌਖਾ ਹੋ ਗਿਆ ਉਸ ਤੋਂ ਬਾਅਦ ਕੁੰਡੀ ਸੋਟਾ ਆਉਂਦਾ ਸੀਗਾ ਪੁਰਾਣੇ ਸਮਿਆਂ ਦੇ ਵਿੱਚ ਜਿਹਦੇ ਨਾਲ ਨੂਣ ਮਿਰਚ ਮਸਾਲਾ ਕੁੱਟ ਕੇ ਸਬਜ਼ੀ ਤਿਆਰ ਕੀਤੀ ਜਾਂਦੀ ਤੀ ਹੁਣ ਅੱਜ ਕੱਲ੍ਹ ਮਿਕਸੀ ਆ ਗਈ ਜਿਹਦੇ ਲਈ ਉਹਦੇ ਵਿੱਚ ਮਸਾਲੇ ਪੀਸ ਕੇ ਮਤਲਬ ਜ਼ਿਆਦਾ ਜਲਦੀ ਆਪਾਂ ਸਮਾਨ ਕੋਈ ਵੀ ਡਿਸ਼ ਤਿਆਰ ਕਰ ਸਕਦੇ ਹਾਂ ਸਬਜ਼ੀ ਤਿਆਰ ਕਰ ਸਕਦੇ ਹਾਂ ਪਹਿਲਾਂ ਲੱਕੜੀਆਂ ਦੇ ਚੁੱਲ੍ਹੇ ਹੁੰਦੇ ਸੀ ਅੰਦਰ ਅਗੀਠੀਆਂ ਹੁੰਦੀਆਂ ਤੀਆਂ ਵੀ ਧੂੰਆਂ ਬਾਹਰ ਜਾਣ ਲਈ ਹੁਣ ਓਹਤੋਂ ਰਾਹਤ ਪਾਉਣ ਲਈ ਅੱਜ ਦੇ ਸਮੇਂ ਦੇ ਵਿੱਚ ਗੈਸ ਸਿਲੈਂਡਰ ਆ ਗਏ ਹੋਰ ਬਿਜਲੀ ਦੇ ਉਪਕਰਣ ਆ ਗਏ ਜਿਨਾਂ ਰਾਹੀਂ ਆਪਾਂ ਜਲਦੀ ਤੋਂ ਜਲਦੀ ਚਾਹ ਹੋ ਗਈ ਸਬਜ਼ੀ ਹੋ ਗਈ ਜਲਦੀ ਤੋਂ ਜਲਦੀ ਤਿਆਰ ਕਰ ਸਕਦੇ ਹੈ ਪਹਿਲਾਂ ਗਰਮ ਕਰਨ ਦੇ ਲਈ ਚੁੱਲ੍ਹੇ ਅਤੇ ਹਾਰੇ ਆਰਿਆਂ ਅਤੇ ਸਮਾਨ ਰੱਖਿਆ ਜਾਂਦਾ ਸੀਗਾ ਪੁਰਾਣੇ ਸਮਿਆਂ ਦੇ ਵਿੱਚ ਹੁਣ ਓਹਦੀ ਜਗ੍ਹਾ ਓਵਨ ਨੇ ਲੈ ਲਈ ਇੱਕ ਮਿੰਟ ਦੇ ਵਿੱਚ ਚੀਜ਼ ਗਰਮ ਪਹਿਲਾਂ ਅਤੇ ਹੁਣ ਦੇ ਟਾਇਮ ਦੇ ਵਿੱਚ ਬਹੁਤ ਫਰਕ ਹੈ ਬੰਦੇ ਦੇ ਨਾਲ ਰਸੋਈਆਂ ਵੀ ਚੇਂਜ ਹੋ